ਮੇਰੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਮੈਂ ਜਦੋਂ ਸਕੂਲ ਤੋਂ ਬਾਅਦ ਇੱਕ ਨਰਸਿੰਗ ਜੁਆਇਨ ਕੀਤੀ ਤਾਂ ਮੇਰੇ ਲਈ ਮੇਰੇ ਘਰ ਦੇ ਵਿੱਚ ਸਭ ਤੋਂ ਪਹਿਲਾ ਮੈਂ ਹੀ ਇੱਕ ਲੜਕੀ ਹੈ ਜਿਹਨੇ ਨਰਸਿੰਗ ਜੁਆਇਨ ਕੀਤੀ ਦੂਜਾ ਇਹ ਜਦੋਂ ਮੈਂ ਨਰਸਿੰਗ ਖਤਮ ਕੀਤੀ ਆ ਤਾਂ ਉਸ ਤੋਂ ਬਾਅਦ ਮੈਂ ਆਪਣੇ ਇੰਨਾਂ ਕੋਨਫ਼ੀਡੈਂਸ ਆ ਗਿਆ ਮੇਰੇ ਦੇ ਵਿ ਮੇਰੇ 'ਚ ਕਿ ਮੈਂ ਕਿਤੇ ਵੀ ਜੌਬ ਕਰ ਸਕਦੀ ਹੈ ਇਕੱਲੀ ਰਹਿ ਸਕਦੀ ਹੈ ਅਤੇ ਫਿਰ ਮੈਂ ਹੋਸਪੀਟਲ ਜੁਆਇੰਨ ਕੀਤਾ ਜਿੱਦਾਂ ਵੀ ਮੈਂ ਕਿਸੇ ਪੇਸ਼ੈਂਟ ਦੀ ਕੇਅਰ ਕਰਦੀ ਸੀਗੀ ਤਾਂ ਮੈਨੂੰ ਬੜੇ ਐਪਰੀਸ਼ੇਟ ਕਰਦੇ ਸੀਗੇ ਸਾਡੇ ਡੋਕਟਰਸ ਹੋ ਗਏ ਸਾਡੇ ਨਾਲ ਦੇ ਸਟਾਫ ਹੋ ਗਏ ਅਤੇ ਹੁਣ ਮੈਨੂੰ ਇੱਦਾਂ ਲੱਗਦਾ ਹੈ ਕਿ ਆਪਣਾ ਜਿਹੜਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਦੀ ਹੈ ਆਪਣੀ ਫ਼ੈਮਿਲੀ ਨੂੰ ਪਾਲ ਸਕਦੀ ਹੈ ਅਤੇ ਮੈਨੂੰ ਬਹੁਤ ਵਧੀਆ ਸੈਲਰੀ ਪੈਕੇਜ ਵੀ ਮਿਲ ਰਿਹਾ ਹੈ ਅਤੇ ਮੈਂ ਆਪਣੀ ਰੁਟੀਨ ਵਾਈਜ਼ ਆਪਣੇ ਡਿਉਟੀ 'ਤੇ ਵੀ ਜਾਂਦੀ ਹੈ ਕਿਉਂਕਿ ਮੈਨੂੰ ਆਪਣਾ ਜਿਹੜਾ ਪ੍ਰੋਫ਼ੈਸ਼ਨ ਹੈ ਉਹ ਬਹੁਤ ਪਸੰਦ ਹੈ ਮੈਨੂੰ ਇਸ ਪ੍ਰਫ਼ੈਸ਼ਨ ਲਈ ਮੈਂ ਜਿੱਦਾਂ ਸਟਰੱਗਲ ਕੀਤਾ ਹੈ ਅਤੇ ਮੈਨੂੰ ਉੱਨਾ ਹੀ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਬਹੁਤ ਵੱਡੀ ਔਪਰਚੁਨਟੀ ਜਿਹੜੀ ਹੈ ਪਾ ਲਈ ਹੈ ਅਤੇ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਇਸ ਚੀਜ਼ ਨੂੰ ਕੰਨਟੀਨਿਉਂ ਹੀ ਕਰਾਂਗੀ ਪੁ ਥਰੂਆਫ ਦ ਲਾਈਫ ਅਤੇ ਜਿੱਦਾਂ ਵੀ ਹੁਣ ਮੈਨੂੰ ਲ ਇਸ ਚੀਜ਼ ਦੇ ਵਿੱਚ ਮੈਨੂੰ ਵੀ ਮਜ਼ਾ ਆਉਣ ਲੱਗ ਗਿਆ ਕੰਮ ਕਰਨ ਦੇ ਵਿੱਚ ਪੇਸ਼ੈਂਟ ਦੀਆਂ ਚੀ ਕੇਅਰ ਕਰਨ ਦੇ ਵਿੱਚ ਉਨ੍ਹਾਂ ਨਾਲ ਗੱਲ ਕਰਨ ਦੇ ਵਿੱਚ ਕਿਉਂਕਿ ਉਹ ਬਹੁਤ ਜ਼ਿਆਦਾ ਜਿੱਦਾਂ ਵੀ ਦੁਖੀ ਹੁੰਦੇ ਹੈ ਤਾਂ ਉਹ ਜਦੋਂ ਵੀ ਆਪਣੀ ਗੱਲ ਸ਼ੇਅਰ ਕਰਦੇ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਸਾਨੂੰ ਆਪਣਾ ਮਹਿਸੂਸ ਕਰਵਾਉਂਦੇ ਹੈ ਅਤੇ ਅਸੀਂ ਉਹਨਾਂ ਦੀ ਅਸੀਂ ਇਸ ਕਾਬਿਲ ਬਣ ਗਏ ਹੈ ਕਿ ਉਹਨਾਂ ਦੀ ਜਿਹੜੀਆਂ ਪਰੋਬਲਮਸ ਹੈ ਉਨ੍ਹਾਂ ਨੂੰ ਅਸੀਂ ਸੋਲਫ਼ ਕਰ ਪਾ ਰਹੇ ਹੈ